ਜਿਸ ਘਰ ਦੇ ਵਿੱਚ ਨਵਾਂ ਬੱਚਾ ਪੈਦਾ ਹੁੰਦਾ ਹੈ ਉਸ ਘਰ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ ਹੈ ਜਿਸ ਘਰ ਦੇ ਵਿੱਚ ਬੱਚਾ ਜਿਸ ਰੂਮ ਦੇ ਵਿੱਚ ਰਹਿੰਦਾ ਉਸਦਾ ਟੈਂਪਰੇਚਰ ਸਹੀ ਰੱਖਿਆ ਜਾਂਦਾ ਹੈ ਤਾਂ ਜੋ ਕਿ ਬੱਚੇ ਦੀ ਸਿਹਤ ਠੀਕ ਰਹੇ ਅਤੇ ਘਰ ਦੇ ਬਾਹਰ ਨਿੰਮ ਦੇ ਪੱਤੇ ਟੰਗੇ ਜਾਂਦੇ ਹਨ ਜੋ ਕਿ ਮੱਖੀ ਮੱਛਰ ਪੈਦਾ ਨਹੀਂ ਹੋਣ ਦਿੰਦੇ ਬੱਚੇ ਦੇ ਨਾਨਕਿਆਂ ਤੋਂ ਬੱਚੇ ਦੇ ਪਰਿਵਾਰ ਲਈ ਅਤੇ ਬੱਚੇ ਲਈ ਨਵੇਂ ਨਵੇਂ ਕੱਪੜੇ ਆਉਂਦੇ ਹਨ ਬੱਚੇ ਵਾਸਤੇ ਨਵਾਂ ਪਾਲਣਾ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਆਉਂਦੇ ਹਨ ਬੱਚੇ ਦੀ ਨਾਨੀ ਬੱਚੇ ਦੀ ਮਾਂ ਲਈ ਦੇਸੀ ਘਿਉ ਦੀ ਪੰਜੀਰੀ ਬਣਾਉਂਦੀ ਹੈ ਤਾਂ ਜੋ ਕਿ ਉਹ ਖਾ ਕੇ ਬੱਚੇ ਨੂੰ ਵਧੀਆ ਮਦਰ ਫੀਡ ਦੇ ਸਕੇ ਜਿਸ ਦੇ ਨਾਲ਼ ਬੱਚੇ ਦੀ ਸਿਹਤ ਠੀਕ ਰਹੇ ਤੀਜੇ ਦਿਨ ਬੱਚੇ ਨੂੰ ਨਵਾਹਿਆ ਜਾਂਦਾ ਹੈ ਅਤੇ ਪਰਿਵਾਰ ਦੇ ਮੋਢੀ ਵੱਲੋਂ ਉਸ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਵੱਖ ਵੱਖ ਰਿਲੀਜ਼ਨਾਂ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਬੱਚੇ ਦਾ ਮੁੰਡਨ ਕਰਵਾਇਆ ਜਾਂਦਾ ਹੈ ਮੁਸਲਿਮ ਧਰਮ ਦੇ ਵਿੱਚ ਬੱਚੇ ਦੇ ਕੰਨ ਦੇ ਵਿੱਚ ਅਜ਼ਾਨ ਪੜ੍ਹੀ ਜਾਂਦੀ ਹੈ ਅਤੇ ਝਾੜਾ ਲਗਾਇਆ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਬੱਚੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਜਾਂਦਾ ਹੈ ਮੱਥਾ ਟਿਕਾਇਆ ਜਾਂਦਾ ਹੈ ਇਹ ਵੱਖ ਵੱਖ ਰਿਲੀਜ਼ਨਾਂ ਦੀ ਵੱਖ ਵੱਖ ਮਾਨਤਾ ਨੇ